ਪਿੰਡਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਮੁਕਾਬਲੇ ਹੁਣ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਚੁੱਕੀ ਹੈ ਬਹੁਤ ਜ਼ਿਆਦੀਆਂ ਜਿਹੜੀਆਂ ਨਵੀਆਂ ਫੈਸਿਲਿਟੀਜ਼ ਨੇ ਉਹ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਕਿ ਹੁਣ ਜਿਹੜੀ ਲਾਈਟ ਹੈ ਪਹਿਲਾਂ ਪਿੰਡਾਂ ਦੇ ਵਿੱਚ ਲਾਈਟ ਦਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਬਟ ਹੁਣ ਜਿਹੜੀ ਲਾਈਟ ਆ ਉਹ ਸਰਕਾਰ ਵੱਲੋਂ ਚੌਵੀ ਘੰਟੇ ਲਾਈਟ ਦਿੱਤੀ ਜਾ ਰਹੀ ਹੈ ਅਤੇ ਜਿਹੜੀਆਂ ਤਾਰਾਂ ਵੀ ਹਨ ਉਹ ਅੰਡਰਗਰਾਊਂਡ ਸ਼ਿਫਟ ਕੀਤੀਆਂ ਜਾ ਜਾ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਇੰਨਾ ਨੁਕਸਾਨ ਨਾ ਹੋਵੇ ਅਤੇ ਜੇ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਜਾਂ ਆਪਾਂ ਖੇਤੀ ਦੇ ਵਿੱਚ ਗੱਲ ਕਰੀਏ ਤਾਂ ਬਿਜਲੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਇਹਦੇ ਵਿੱਚ ਜਿੱਦਾਂ ਕਿ ਮੋਟਰ ਹੋ ਗਈ ਜਾਂ ਟਿਊਬਵੈਲ ਹੋ ਗਏ ਇਹ ਸਾਰੇ ਪ੍ਰੋਵਾਈ ਪਾਣੀ ਦੇ ਲਈ ਪ੍ਰੋਵਾਈਡ ਕਰਵਾਉਣ ਦੇ ਲਈ ਇਹ ਆਪਾਂ ਨੂੰ ਜ਼ਿਆਦਾ ਬਿਜਲੀ ਦੀ ਲੋੜ ਪੈਂਦੀ ਹੈ ਜਿਵੇਂ ਕਿ ਹੁਣ ਲਗਾ ਲਓ ਕਿ ਗਵਰਨਮੈਂਟ ਵੱਲੋਂ ਵੀ ਜਿਹੜੀ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਕਾਫੀ ਸਾਰੀਆਂ ਮਸ਼ੀਨਾਂ ਇੱਦਾਂ ਦੀਆਂ ਹਨ ਜੋ ਕਿ ਬਿਜਲੀ ਦੇ ਉੱਪਰ ਚਾਰਜ ਹੁੰਦੀਆਂ ਹਨ ਅਤੇ ਜਦੋਂ ਬਿਜਲੀ ਨਹੀਂ ਹੁੰਦੀ ਲੋਕ ਉਹਨੂੰ ਕਿਸਾਨ ਉਹਨਾਂ ਨੂੰ ਯੂਸ ਕਰ ਲੈਂਦੇ ਹਨ ਅਤੇ ਓਵਰਆਲ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਖੇਤੀ ਹੈ ਉਹ ਬਿਜਲੀ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡ ਕਰ ਰਹੀ ਹੈ